ਕਵਾਲੀਆਂ ਮੇਲੇ ਅਤੇ ਮਸਜਿਦਾਂ ਵਿੱਚ ਗਾਈਆਂ ਜਾਂਦੀਆਂ ਹਨ ਪੀਰਾਂ 'ਤੇ ਵੀ ਗਾਈਆਂ ਜਾਂਦੀਆਂ ਹਨ ਇਹਨਾਂ ਨੂੰ ਪੰਜਾਬ ਪੁਰਾਣੇ ਬਜ਼ੁਰਗ ਲਿਖਦੇ ਸੀ ਅਤੇ ਸੰਭਾਲਦੇ ਸੀ ਅਜੋਕੇ ਸਮੇਂ ਵਿੱਚ ਵੀ ਬਹੁਤ ਕਲਾਕਾਰ ਹਨ ਜੋ ਇਸ ਸੰਭਾਲ ਕਰਦੇ ਹਨ ਮੇਲਿਆਂ 'ਤੇ ਗਾ ਕੇ ਪੀਰਾਂ 'ਤੇ ਗਾ ਕੇ ਇਸ ਨੂੰ ਧਾਰਮਿਕ ਤੌਰ 'ਤੇ ਦੇਖਿਆ ਜਾਂਦਾ ਹੈ ਵੀ ਇੱਕ ਧਾਰਮਿਕ ਤੌਰ 'ਤੇ ਕਵਾਲੀ ਗਾਈ ਜਾਂਦੀ ਹੈ